ਜੈਕਟ ਦਾ ਜਿਹੜਾ ਰੇਟ ਸੀ ਉਹ ਬਹੁਤ ਜ਼ਿਆਦਾ ਸੀ ਅਤੇ ਮੈਨੂੰ ਧੁਆਉਣ ਲਈ ਵੀ ਹਰ ਵਾਰ ਡਰਾਇਕਲੀਨਰ ਕੋਲ ਹੀ ਜਾਣਾ ਪੈਂਦਾ ਹੈ